ਭਾਰਤ ਵਿੱਚ ਬਹੁਤ ਹੀ ਜ਼ਿਆਦਾ ਕਲਾ ਪਾਈਆਂ ਜਾਂਦੀਆਂ ਹਨ ਜੇਕਰ ਗੱਲ ਕਰਾਂ ਪੰਜਾਬ ਦੀ ਤਾਂ ਇੱਥੇ ਮਿੱਟੀ ਦੇ ਬਰਤਨ ਦੀ ਕਲਾ ਬਹੁਤ ਹੀ ਜ਼ਿਆਦਾ ਮਸ਼ਹੂਰ ਸੀ ਪਹਿਲੇ ਸਮਿਆਂ ਵਿੱਚ ਮਿੱਟੀ ਦੇ ਬਰਤਨ ਬਹੁਤ ਹੀ ਜ਼ਿਆਦਾ ਪ੍ਰਚਲਿਤ ਸੀ ਇਹਨਾਂ ਦੇ ਉੱਤੇ ਬਹੁਤ ਹੀ ਕਲਾਕਾਰੀਆਂ ਕੀਤੀਆਂ ਹੁੰਦੀਆਂ ਸੀ ਅਲੱਗ ਅਲੱਗ ਡਿਜ਼ਾਇਨ ਬਣਾਏ ਜਾਂਦੇ ਸਨ ਪਰ ਅੱਜ ਇਹਨਾਂ ਬਰਤਨਾਂ ਦੀ ਜਗ੍ਹਾ ਸਟੀਲ ਅਤੇ ਹੋਰ ਧਾਤ ਦੇ ਬਰਤਨਾਂ ਨੇ ਲੈ ਲਈ ਹੈ ਇਸ ਤੋਂ ਇਲਾਵਾ ਗੱਲ ਕਰੀਏ ਤਾਂ ਕਢਾਈ ਬੁਣਾਈ ਆਦਿ ਬਹੁਤ ਹੀ ਜ਼ਿਆਦਾ ਪ੍ਰਚਲਿਤ ਸੀ ਲੋਕ ਕਢਾਈ ਕੱਢਦੇ ਸਨ ਅਤੇ ਫੁਲਕਾਰੀਆਂ ਲੈਂਦੇ ਸਨ ਚਾਦਰੇ ਲਾਉਂਦੇ ਸਨ ਪਰ ਅੱਜ ਕੱਲ੍ਹ ਇਹਨਾਂ ਦਾ ਰਿਵਾਜ਼ ਬਹੁਤ ਹੀ ਜ਼ਿਆਦਾ ਘੱਟ ਗਿਆ ਹੈ ਇਸ ਤੋਂ ਇਲਾਵਾ ਭੰਗੜਾ ਗਿੱਧਾ ਵੀ ਅਲੋਪ ਹੀ ਹੁੰਦਾ ਜਾ ਰਿਹਾ ਹੈ ਇਸ ਦੀ ਜਗ੍ਹਾ ਬਹੁਤ ਹੀ ਨਵੇਂ ਨ੍ਰਿੱਤ ਆ ਗਏ ਹਨ ਜਿਵੇਂ ਕਿ ਹਿਪ ਹੋਪ ਬਰੇਕਡਾਂਸ ਆਦਿ ਨੇ ਭੰਗੜੇ ਅਤੇ ਗਿੱਧੇ ਦੀ ਜਗ੍ਹਾ ਲੈ ਲਈ ਹੈ ਇਸ ਤੋਂ ਇਲਾਵਾ ਚਿੱਤਰਕਾਰੀਆਂ ਵੀ ਬਹੁਤ ਹੀ ਅਲੋਪ ਹੁੰਦੀਆਂ ਜਾ ਰਹੀਆਂ ਹਨ ਪਹਿਲਾਂ ਘਰਾਂ ਦੀਆਂ ਦੀਵਾਰਾਂ ਉੱਤੇ ਤਸਵੀਰਾਂ ਲਗਾਈਆਂ ਜਾਂਦੀਆਂ ਸਨ ਅਤੇ ਬਹੁਤ ਹੀ ਪੁਰਾਣੀਆਂ ਚੀਜ਼ਾਂ ਨਾਲ ਘਰ ਸਜਾਇਆ ਜਾਂਦਾ ਸੀ ਪਰ ਅੱਜ ਇਹਨਾਂ ਦੀ ਜਗ੍ਹਾ ਫੋਟੋਗ੍ਰਾਫੀ ਨੇ ਲੈ ਲਈ ਹੈ ਲੋਕ ਆਪਣੀਆਂ ਤਸਵੀਰਾਂ ਖਿੱਚ ਕੇ ਕੰਧਾਂ ਉੱਤੇ ਲਗਾਉਂਦੇ ਹਨ ਘਰਾਂ ਦੀਆਂ ਦੀਵਾਰਾਂ ਉੱਤੇ ਸ਼ੀਸ਼ਿਆਂ ਅਤੇ ਟੁੱਟੀਆਂ ਫੁੱਟੀਆਂ ਪੁਰਾਣੀਆਂ ਚੀਜ਼ਾਂ ਦੀ ਜੋ ਸਜਾਵਟ ਹੁੰਦੀ ਸੀ ਉਹ ਅਲੋਪ ਹੋ ਗਈ ਹੈ ਅੱਜ ਕੱਲ੍ਹ ਇਹ ਕੁਝ ਨਹੀਂ ਹੁੰਦਾ ਪਰ ਮੈਨੂੰ ਲੱਗਦਾ ਹੈ ਕਿ ਪੁਰਾਣੀ ਸੱਭਿਅਤਾ ਨੂੰ ਵਾਪਸ ਲਿਆਉਣਾ ਚਾਹੀਦਾ ਹੈ ਜੋ ਚੀਜ਼ ਪੁਰਾਣੀ ਸੱਭਿਅਤਾ ਵਿੱਚ ਸੀ ਉਹ ਸੁੱਖ ਅੱਜ ਦੀਆਂ ਬਣਾਵਟੀ ਚੀਜ਼ਾਂ ਵਿੱਚ ਨਹੀਂ ਹੈ